ਅੱਜ ਕੱਲ੍ਹ ਗੇਮਿੰਗ ਦਾ ਬਹੁਤ ਰਿਵਾਜ਼ ਵੱਧ ਚੁੱਕਾ ਹੈ ਔਰ ਔਨਲਾਈਨ ਗੇਮਿੰਗ ਦੇ ਵਿੱਚ ਲੋਕ ਔਰ ਖਾਸ ਤੌਰ 'ਤੇ ਯੰਗ ਜਿਹੜੇ ਲੋਕ ਨੇ ਉਹ ਬਹੁਤ ਇੰਟਰਸਟ ਲੈ ਰਹੇ ਹਨ ਔਰ ਇਹਦੇ ਵਿੱਚ ਗੌਰਮੈਂਟ ਨੇ ਕਈ ਤਰ੍ਹਾਂ ਦੇ ਕਾਨੂੰਨ ਬਣਾ ਕੇ ਜੀ ਐੱਸ ਟੀ ਵਗੈਰਾ ਵਧਾ ਕੇ ਇਹਨਾਂ 'ਤੇ ਬਹੁਤ ਤਰ੍ਹਾਂ ਦੇ ਟੈਕਸ ਲਗਾ ਦਿੱਤੇ ਹਨ ਜਿਹਦੇ ਕਰਕੇ ਔਨਲਾਈਨ ਗੇਮਿੰਗ ਦੇ ਵਿੱਚ ਲੋਕਾਂ ਦਾ ਰੁਝਾਨ ਘੱਟਦਾ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਗੌਰਮੈਂਟ ਔਨਲਾਈਨ ਗੇਮਿੰਗ ਨੂੰ ਇੱਕ ਤਰ੍ਹਾਂ ਦਾ ਜੂਆ ਸਮਝਦੀ ਹੈ ਔਰ ਇਸ ਨੂੰ ਡਿਸਕਰੇਜ ਕਰਨ ਦੀ ਹਰ ਵੇਲੇ ਕੋਸ਼ਿਸ਼ ਕਰ ਰਹੀ ਹੈ ਔਰ ਇਸ ਇੰਡਸਟਰੀ ਦਾ ਭਵਿੱਖ ਉਹਦੇ ਮੁਤਾਬਕ ਹੀ ਨਿਰਭਰ ਕਰਦਾ ਹੈ ਕਿ ਗੌਰਮੈਂਟ ਇਹਦੇ 'ਤੇ ਕੀ ਡਿਸੀਜ਼ਨ ਲੈਂਦੀ ਹੈ